ਕਵਿਤਾ ਸਹਿਤ ਰੂਪ ਨੂੰ ਦੁਨੀਆਂ ਦੀਆਂ ਲਗਭਗ ਸਾਰੀਆਂ ਭਾਸ਼ਾਵਾਂ ਵਿੱਚ ਬਾਕੀ ਸਾਹਿਤ ਰੂਪਾਂ ਨਾਲੋਂ ਪਹਿਲਾਂ ਜਨਮੀ ਮੰਨਿਆ ਜਾਂਦਾ ਹੈ ਇਸ ਲਈ ਇਸ ਨੂੰ ਸਹਿਤ ਰੂਪਾਂ ਵਿੱਚੋਂ ਜੇਠੀ ਅਤੇ ਪਲੇਠੀ ਵੀ ਕਿਹਾ ਜਾਂਦਾ ਹੈ ਕੁਝ ਵਿਦਵਾਨਾਂ ਦਾ ਮੱਤ ਹੈ ਕਿ ਆਦਿ ਮਾਨਵ ਵੱਲੋਂ ਖੁਸ਼ੀ ਵਿੱਚ ਮਾਰੀ ਗਈ ਕਿਲਕਾਰੀ ਜਾਂ ਦੁੱਖ ਵਿੱਚ ਉਸ ਦੇ ਅੰਦਰੋਂ ਨਿਕਲਣ ਵਾਲੀ ਵੇਦਨਾ ਭਰੀ ਚੀਕਾਂ